ਹਾਂਜੀ ਨਮਸ਼ਕਾਰ ਜੀ ਆਹੋ ਠੀਕ ਆ ਜੀ ਹੋਰ ਸੁਣਾਓ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਜੀ ਬੜਾ ਬੁਰਾ ਬਹੁਤ ਜ਼ਿਆਦਾ ਟਰਾਫੀਕ ਆ ਜੀ ਇੱਥੇ ਸ਼ਾਮ ਨੂੰ ਨਿਕਲਿਆ ਨਹੀਂ ਜਾਂਦਾ

ਹਾਂਜੀ ਹਾਂਜੀ ਜੀ ਬਹੁਤ ਬੁਰਾ ਹਾਲ ਹੈ ਜੀ ਹਾਂ ਹਾਂ ਓਕ ਹਾਂਜੀ ਹਾਂਜੀ ਛੱਡੋ ਹਾਂਜੀ ਜਾਣਾ ਜੀ ਆਪਣੇ ਘਰੇ ਅਸੀਂ ਬੜਾ ਬੁਰਾ ਹਾਲ ਹੈ ਜੀ